ਹਾਂ ਮੈਂ ਮੰਨਦੀ ਹਾਂ ਕਿ ਖੇਡਾਂ ਵਿਦਿਆਰਥੀਆਂ ਦੇ ਜੀਵਨ ਵਿੱਚ ਬਹੁਤ ਹੀ ਮਹੱਤਵਪੂਰਨ ਹੁੰਦੀਆਂ ਹਨ ਖੇਡਾਂ ਨਾਲ਼ ਵਿਦਿਆਰਥੀ ਬਹੁਤ ਕੁਝ ਸਿੱਖਦੇ ਹਨ ਪੜ੍ਹਾਈ ਦੇ ਨਾਲ਼ ਨਾਲ਼ ਖੇਡਾਂ ਬਹੁਤ ਹੀ ਜ਼ਰੂਰੀ ਹਨ ਅੱਜ ਕੱਲ੍ਹ ਹਰ ਇੱਕ ਸਕੂਲ ਵਿੱਚ ਖੇਡਾਂ ਲਾਜ਼ਮੀ ਹਨ ਪੜ੍ਹਾਈ ਵਿੱਚ ਤਾਂ ਬੱਚੇ ਅੱਵਲ ਆਉਂਦੇ ਹੀ ਹਨ ਪਰ ਖੇਡਾਂ ਨਾਲ਼ ਉਹਨਾਂ ਦੀ ਬਹੁਤ ਮਦਦ ਹੁੰਦੀ ਹੈ ਖੇਡਾਂ ਨਾਲ਼ ਬੱਚੇ ਬਹੁਤ ਕੁਝ ਸਿੱਖਦੇ ਹਨ ਉਹਨਾਂ ਅੰਦਰ ਸਹਿਨਸ਼ੀਲਤਾ ਆਉਂਦੀ ਹੈ ਪੜ੍ਹਾਈ ਵਿੱਚ ਮਦਦ ਹੁੰਦੀ ਹੈ ਅਤੇ ਉਹ ਹਰ ਰੋਜ਼ ਤਰੋ ਤਾਜ਼ਾ ਮਹਿਸੂਸ ਕਰਦੇ ਹਨ ਖੇਡਾਂ ਨਾਲ਼ ਉਹਨਾਂ ਨੂੰ ਬਹੁਤ ਫਾਇਦਾ ਹੈ ਪੜ੍ਹਾਈ ਦੇ ਨਾਲ਼ ਨਾਲ਼ ਖੇਡਾਂ ਦਾ ਵੀ ਬਹੁਤ ਮਹੱਤਵ ਹੈ ਖੇਡਾਂ ਉਨੀਆਂ ਹੀ ਜ਼ਰੂਰੀ ਹਨ ਜਿੰਨੀ ਕਿ ਪੜ੍ਹਾਈ